ਸਤਿ ਸ਼੍ਰੀ ਅਕਾਲ ਜੀ ਤੁਹਾਡੇ ਕੋਲੋਂ ਜਿਹੜਾ ਔਨਲਾਈਨ ਸੋਫਾ ਮੰਗਵਾਇਆ ਉਹ ਬੜਾ ਸਾਫ਼ ਸੁਥਰਾ ਅਤੇ ਸੋਹਣਾ ਲੱਗਦਾ ਇਹਦੀਆਂ ਸੀਟ ਸੀਟ ਕਵਰ ਨੇ ਜਿਹੜੇ ਉਹ ਬਹੁਤ ਪੋਲੇ ਅਤੇ ਬੈਠਣੇ ਨੂੰ ਬੜੀ ਆਰਾਮਦਾਈ ਮਿਲਦੀ ਹੈ ਔਰ ਜਦੋਂ ਵੀ ਬੰਦਾ ਦੇਖਦਾ ਇਹ ਸੋਫੇ ਨੂੰ ਦੇਖ ਕੇ ਬੜਾ ਹੀ ਖੁਸ਼ ਹੁੰਦਾ ਕਹਿੰਦੇ ਹੈ ਵੀ ਕਿੱਥੋਂ ਮੰਗਵਾਇਆ ਸੋਫਾ ਸੋਫਾ ਬੜਾ ਵਧੀਆ ਅਤੇ ਇਹਦੀ ਲੱਕੜ ਵਧੀਆ ਸਾਗਵਾਨ ਦੀ ਲੱਕੜ ਹੈ ਅਤੇ ਉੱਤੇ ਜਿਹੜਾ ਕੱਪੜਾ ਚਾੜ੍ਹਿਆ ਹੋਇਆ ਉਹ ਵੀ ਬਹੁਤ ਸੁੰਦਰ ਹੈ ਦੇਖਣ ਨੂੰ ਬੜਾ ਵਧੀਆ ਲੱਗਦਾ ਹੈ ਆਇਆ ਗਿਆ ਜੋ ਵੀ ਬੰਦਾ ਆਉਂਦਾ ਹੈ ਇਸ ਨੂੰ ਇਹਦੀ ਸਿਫ਼ਤ ਕਰਦਾ ਹੈ ਵੀ ਕਿੱਥੋਂ ਮੰਗਵਾਇਆ ਸੋਫਾ ਤਾਂ ਫਿਰ ਮੈਂ ਦੱਸਦਾ ਹੈਗਾ ਵੀ ਭਾਈ ਮੈਂ ਔਨਲਾਈਨ ਐਨਾ ਨੰਬਰ ਦੁਕਾਨ ਦੇ ਉੱਤੋਂ ਇੰਡਸਟਰੀ ਏਰੀਏ ਤੋਂ ਮੰਗਵਾਇਆ ਹੈ ਜੇ ਤੁਸੀਂ ਵੀ ਮੰਗਵਾਉਣਾ ਹੈ ਤਾਂ ਅਸੀਂ ਤੁਹਾਨੂੰ ਉਸ ਦਾ ਐਡਰੈੱਸ ਦੇ ਦਿੰਦੇ ਹਾਂ ਔਨਲਾਈਨ ਛੱਡ ਜਾਣ ਘਰ ਛੱਡ ਜਾਣਗੇ ਘਰ ਛੱਡਣ ਵਾਲਾ ਬੰਦਾ ਵੀ ਬੜਾ ਵਧੀਆ ਬੰਦਾ ਸੀ ਬੜੀ ਮਿੱਠ ਬੋਲੜਾ ਸੀ ਅਤੇ ਘਰ ਅੰਦਰ ਛੱਡ ਕੇ ਸੈੱਟ ਕਰਕੇ ਜਿੰਨੇ ਬਾਏ ਜਿੰਨੇ ਦਾ ਅਸੀਂ ਸੋਫਾ ਬਣਵਾਇਆ ਉੱਨੇ ਹੀ ਸਾਈਜ਼ ਦਾ ਪੂਰਾ ਪੂਰਾ ਆਇਆ ਉਹਦੇ ਵਿੱਚ ਕੋਈ ਵੱਧ ਨਹੀਂ ਕੋਈ ਘੱਟ ਨਹੀਂ ਹੈਗਾ ਔਰ ਦੇਖਣੇ ਨੂੰ ਬੜਾ ਸੁੰਦਰ ਲੱਗਦਾ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ